ਅੱਜ ਕੱਲ੍ਹ ਜਿਹੜਾ ਖੇਤੀ ਹੈ ਇਹ ਬਾਹਲਾ ਮਤਲਬ ਲਾਹੇਵੰਦ ਧੰਦਾ ਨਹੀਂ ਰਿਹਾ ਅਸੀਂ ਦੇਖ ਰਹੇ ਜਦੋਂ ਕਿਸਾਨ ਖੇਤੀ ਕਰਦਾ ਕਈ ਵਾਰ ਕੀ ਹੁੰਦਾ ਉਹਨੂੰ ਬੜੀਆਂ ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਈ ਵਾਰ ਕੀ ਹੁੰਦਾ ਜਦੋਂ ਫਸਲ ਪੂਰੀ ਪੱਕ ਚੱਕੀ ਹੁੰਦੀ ਆ ਉਦੋਂ ਕਈ ਵਾਰ ਹੜ੍ਹ ਆ ਜਾਂਦੇ ਆ ਜਿਆਦਾ ਮੀਂਹ ਪਈ ਜਾਂਦਾ ਅਤੇ ਕਈ ਵਾਰ ਕੀ ਹੁੰਦਾ ਜਦੋਂ ਆਪਾਂ ਦੇਖਦੇ ਹਾਂ ਵੀ ਸਾਨੂੰ ਫਸਲ ਨੂੰ ਪਾਣੀ ਦੀ ਲੋੜ ਹੈ ਉਦੋਂ ਸੋਕਾ ਲੱਗ ਜਾਂਦਾ ਕਈ ਵਾਰ ਸਰਦੀ 'ਚ ਜ਼ਿਆਦਾ ਧੁੰਦ ਵਗੈਰਾ ਪੈ ਕੇ ਜਿਹਦੇ ਨਾਲ ਆਹ ਜਿਹੜੇ ਬੂਟੇ ਨੇ ਗੜੇ ਪੈਂਦੇ ਨੇ ਫਸਲ ਝੜ ਜਾਂਦੀ ਹੈ ਤੂਫਾਨ ਨਾਲ ਫਸਲਾਂ ਡਿੱਗ ਜਾਂਦੀਆਂ ਨੇ ਇਸ ਤਰ੍ਹਾਂ ਦੀਆਂ ਕਿਸਾਨਾਂ ਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਖੇਤੀ 'ਚ ਬਹੁਤ ਜ਼ਿਆਦਾ ਨੁਕਸਾਨ ਉਠਾਉਣਾ ਪੈਂਦਾ ਜੋਖਮ ਦਾ ਕੰਮ ਹੋ ਗਿਆ ਖੇਤੀ ਇਸ ਟਾਈਮ ਕੁੱਲ ਮਿਲਾ ਕੇ ਅਤੇ ਕਿਸਾਨ ਵੀ ਵਿਚਾਰਾ ਕਿਵੇਂ ਨਜਿੱਠਦਾ ਇਹਦੇ ਨਾਲ ਕਈ ਵਾਰ ਮੀਂਹ ਫਸਲ ਮੰਡੀ 'ਚ ਪਈ ਹੁੰਦੀ ਹੈ ਮੀਂਹ ਪੈਣ ਲੱਗ ਜਾਂਦਾ ਅਤੇ ਉਹਨੂੰ ਮੌਕੇ 'ਤੇ ਤਰਪਾਲਾਂ ਵਗੈਰਾ ਲਿਆ ਕੇ ਢੱਕਣੀਆਂ ਪੈਂਦੀਆਂ ਅਤੇ ਹੁਣ ਵੈਸੇ ਕਈ ਸਰਕਾਰ ਨੇ ਸ਼ੈੱਡ ਵੀ ਬਣਾ ਕੇ ਦਿੱਤੇ ਨੇ ਬਾਕੀ ਜਿਹੜਾ ਨੁਕਸਾਨ ਹੈ ਕਈ ਵਾਰ ਹੁਣ ਚਲੋ ਸਰਕਾਰ ਕੋਈ ਕਿਸਾਨਾਂ ਨੂੰ ਫੌਰੀ ਰਾਹਤ ਵੀ ਦੇ ਰਹੀ ਹੈ ਕੋਈ ਇਹਨਾਂ ਨੂੰ ਕਈ ਫੰਡ ਕਾਇਮ ਕੀਤੇ ਨੇ ਉਹਦੇ ਨਾਲ ਕਿਸਾਨ ਦਾ ਕੁਝ ਬਚਾਅ ਹੋ ਰਿਹਾ ਅਤੇ ਪਰ ਇਹ ਮੁਸ਼ਕਿਲਾਂ ਜਿਹੜੀਆਂ ਨੇ ਕਿਸਾਨ ਨੂੰ ਨਿਰੰਤਰ ਆ ਰਹੀਆਂ ਨੇ ਖੇਤੀ 'ਚ ਹੁਣ ਲਗਾਤਾਰ ਆ ਰਹੀਆਂ ਜਿਹੜੇ ਨੁਕ ਕਿਸਾਨ ਦਾ ਨੁਕਸਾਨ ਹੋ ਰਿਹਾ ਉਹੀ ਜਾਣਦਾ ਇਹਦੀ ਭਰਪਾਈ ਕਰਨੀ ਬਹੁਤ ਔਖੀ ਹੈ ਕਈ ਵਾਰ ਕਿਸਾਨ ਟੁੱਟ ਜਾਂਦਾ ਇਹਦੇ ਨਾਲ ਅਤੇ ਖੁਦਕੁਸ਼ੀਆਂ ਤੱਕ ਪਹੁੰਚ ਜਾਂਦਾ ਅਸੀਂ ਦੇਖਦੇ ਹਾਂ ਅਤੇ ਸਰਕਾਰ ਵੀ ਪ੍ਰਬੰਧ ਕਰ ਰਹੀਆਂ ਨੇ ਨਜਿੱਠਣ ਲਈ ਹੈਲਪ ਕਰ ਰਹੀ ਹੈ ਇਹਦੇ ਲਈ ਤੋ ਇਹੀ ਕੁਝ ਹੈ ਇਹਦੇ ਵਿੱਚ